ਹੈਲੋ ਹਾਂਜੀ ਭਾਅ ਜੀ ਤੁਹਾਡੇ ਕੋਲ ਕਿਹੜੇ ਕਿਹੜੇ ਸ਼ੂਜ ਦੇ ਬ੍ਰਾਂਡ ਪਏ ਐ ਕਿਸ ਕਿਸ ਬ੍ਰਾਂਡ ਦੇ ਅੱਛਾ ਜੀ ਇਥੇ ਤੇ ਕਿਸ ਤਰ੍ਹਾਂ ਦੇ ਲੈਣੇ ਚਾਹੀਦੇ ਆ ਲੈਦਰ ਵਗੈਰਾ ਕੱਪੜੇ ਦੇ ਜਦੋਂ ਤੁਸੀਂ ਤਾਂ ਵੇਚਦੇ ਹੋ ਤੁਹਾਨੂੰ ਤਾਂ ਪਤਾ ਹੋਏਗਾ ਕਿਹੜਾ ਮਟੀਰੀਅਲ ਵਧੀਆ ਰਹਿੰਦਾ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਠੀਕ ਹ ਨਾ ਹਵਾ ਲਵਾਉਂਦੇ ਰਹੇ ਅੱਛਾ ਤੇ ਇਸਕੇ ਚ ਸਕੈਚਰ ਵਿੱਚ ਕੀ ਡਿਸਕਾਊਂਟ ਵਗੈਰਾ ਹੈ ਤੁਹਾਡੀ ਦੁਕਾਨ ਤੇ ਅੱਛਾ ਜੀ ਅੱਛਾ ਜੀ ਤੁਹਾਡੇ ਕੋਲ ਸਾਰੇ ਨਿਊ ਮਾਡਲ ਆਏ ਹੋਏ ਆ ਜਾਂ ਸੇਲ ਵਾਲੇ ਹੀ ਹੈ ਅੱਛਾ ਜੀ ਅੱਛਾ ਜੀ ਅਸੀਂ ਫਾਜ਼ਿਲਕਾ ਤੋਂ ਰਾਧਾ ਸੁਆਮੀ ਕਲੋਨੀ ਚੋ ਹੀ ਬੋਲ ਰਹੇ ਆ ਅੱਛਾ ਨਹੀਂ ਜੀ ਸਾਨੂੰ ਨਹੀਂ ਪਤਾ ਹਾਂਜੀ ਨਹੀਂ ਪਤਾ ਚੱਲਿਆ ਜੀ ਅੱਛਾ ਜਿੱਦਾ ਜਿਵੇਂ ਹੁੰਦਾ ਨਾ ਕਿਸੇ ਦੁਕਾਨ ਦਾ ਫੇਲ ਵਿੱਚ ਆਪਾਂ ਕਰਦੇ ਆ ਤਾਂ ਬਹੁਤ ਟਾਈਮ ਤੋਂ ਹੁੰਦਾ ਉਹ ਆਉਂਦੇ ਹੀ ਖਰਾਬ ਹੋ ਜਾਂਦੇ ਸ਼ੂਜ਼ ਉਦਾਂ ਦੀ ਕੋਈ ਦਿੱਕਤ ਤਾਂ ਨਹੀਂ ਅੱਛਾ ਜੀ ਠੀਕ ਏ ਤੇ ਸਕੈਚਰ ਵਿੱਚ ਸਭ ਬੱਚੇ ਵਗੈਰਾ ਦੇ ਲੇਡੀਜ ਲੁੱਕ ਗਰਲਿਸ਼ ਲੁੱਕ ਸਭ ਟਾਈਪ ਤੇ ਹੈਗੇ ਆ ਤੁਹਾਡੇ ਕੋਲ ਅੱਛਾ ਜੀ ਅੱਛਾ ਤੁਸੀਂ ਥੋੜਾ ਡਿਸਕਾਊਂਟ ਵਧਾ ਨੀ ਸਕਦੇ ਇਨਦਾ ਅੱਛਾ ਜੀ ਅੱਛਾ ਨਹੀਂ ਮਤਲਬ ਤੁਸੀਂ ਇਹ ਕਹਿੰਦੇ ਹੋ ਲੈਦਰ ਨਾਲੋਂ ਥੋੜਾ ਜਿਆਦਾ ਕੱਪੜੇ ਵਾਲੇ ਨੂੰ ਜਿਆਦਾ ਪ੍ਰੈਫਰ ਦੇਣਾ ਚਾਹੀਦਾ ਹਾਂਜੀ ਹਾਂਜੀ ਉਹੀ ਇਹਨਾਂ ਪਾਰਟੀ ਉਹ ਸਮਝ ਹੀ ਰਹਿ ਜਾਂਦੇ ਆ ਫਿਰ ਖਰਾਬ ਹੋ ਜਾਂਦੇ ਆ ਲੈਦਰ ਦੀ ਕੰਪਲੇਂਟ ਬਹੁਤ ਜਲਦੀ ਹਾਂਜੀ ਹਾਂਜੀ ਠੀਕ ਹ ਅਸੀਂ ਤੁਹਾਡੀ ਦੁਕਾਨ ਤੇ ਵਿਜਿਟ ਕਰਦੇ ਆਂ ਫਿਰ ਦੇਖਦੇ ਆਂ ਜਦੋਂ ਕੰਫਰਟੇ ਹਾਂਜੀ ਠੀਕ ਏ ਧੰਨੇਵਾਦ ਓਕੇ